ਮੈਂ ਸਕੂਲ ਦੇ ਇਕ ਫੰਕਸ਼ਨ ਦੇ ਵਿੱਚ ਬਚਪਨ ਵਿੱਚ ਹਿੱਸਾ ਲਿਆ ਸੀ ਜਦੋਂ ਅਸੀਂ ਸਕੂਲ ਜਾਂਦੇ ਸੀ ਔਰ ਸਾਡੇ ਪ੍ਰਿੰਸੀਪਲ ਮਤਲਬ ਟੀਚਰਾਂ ਵੱਲੋਂ ਛੋਟਾ ਜਿਹਾ ਫੰਕਸ਼ਨ ਕੀਤਾ ਗਿਆ ਸੀ ਔਰ ਕਈ ਬੱਚਿਆਂ ਨੇ ਉਸ ਦੇ ਵਿੱਚ ਗਿੱਧੇ 'ਚ ਔਰ ਕਈ ਬੱਚਿਆਂ ਨੇ ਭੰਗੜੇ 'ਚ ਔਰ ਕਈ ਬੱਚਿਆਂ ਨੇ ਚੁਟਕਲਿਆਂ 'ਚ ਭਾਗ ਲਿਆ ਸੀ ਔਰ ਬਚਪਨ ਦੇ ਵਿੱਚ ਅਸੀਂ ਸਾਨੂੰ ਬਹੁਤ ਤਜਰਬਾ ਸੀ ਔਰ ਬਹੁਤ ਵਧੀਆ ਲੱਗਾ ਸਾਨੂੰ ਉਸ ਫੰਕਸ਼ਨ 'ਚ ਭਾਗ ਲੈ ਕੇ ਔਰ ਅਸੀਂ ਸਾਰੇ ਟੀਚਰ ਬੱਚੇ ਅਸੀਂ ਇਕੱਠੇ ਖਾਂਦੇ ਪੀਂਦੇ ਸੀ ਔਰ ਇੱਕ ਜਗ੍ਹਾ ਬੈਠ ਕੇ ਅਸੀਂ ਇੰਜੋਏ ਕੀਤਾ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਮਜ਼ਾ ਆਇਆ ਉਹ ਫੰਕਸ਼ਨ ਦੇਖ ਕੇ ਔਰ ਸਾਨੂੰ ਬਹੁਤ ਯਾਦਗਾਰ ਰਿਹਾ ਉਹ ਫੰਕਸ਼ਨ ਔਰ ਅੱਜ ਵੀ ਅਸੀਂ ਉਸ ਫੰਕਸ਼ਨ ਨੂੰ ਚੇਤੇ ਕਰਦੇ ਹਾਂ ਔਰ ਬਹੁਤ ਸਾਨੂੰ ਵਧੀਆ ਲੱਗਿਆ ਬਹੁਤ ਮਜ਼ਾ ਆਇਆ ਇਹੋ ਹੀ ਸਾਡਾ ਬਚਪਨ ਦਾ ਤਜਰਬਾ ਸੀ ਔਰ ਅਸੀਂ ਬਹੁਤ ਹੱਸੇ ਖੇਡੇ ਬਹੁਤ ਮਜ਼ਾ ਕੀਤਾ ਅਸੀਂ ਉਸ ਫੰਕਸ਼ਨ ਦੇ ਵਿੱਚ